ਗਲੋਬਲ ਮਿਊਜ਼ਿਕ ਇੰਡਸਟਰੀ ਵਿੱਚ ਪੰਜਾਬੀ ਮਿਊਜ਼ਿਕ ਨੇ ਇੱਕ ਖਾਸ ਸਥਾਨ ਬਣਾ ਲਿਆ ਹੈ ਅੱਜ ਹਰ ਕੋਈ ਪੰਜਾਬੀ ਮਿਊਜ਼ਿਕ ਤੋਂ ਜਾਣੂ ਹੈ ਪੰਜਾਬੀ ਇੰਡਸਟਰੀ ਦੇ ਕੁਝ ਖਾਸ ਕਲਾਕਾਰ ਜੋ ਕਿ ਗਲੋਬਲ ਪੱਧਰ ਉੱਤੇ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ ਜਿਵੇਂ ਸਿੱਧੂ ਮੂਸੇਵਾਲਾ ਏ ਪੀ ਢਿੱਲੋਂ ਦਲਜੀਤ ਦੁਸਾਂਝ ਜੋ ਜੋ ਹਨੀ ਸਿੰਘ ਜੈਜ਼ੀ ਬੀ ਮੀਕਾ ਸਿੰਘ ਆਦਿ ਪਰ ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਲਾਕਾਰ ਹਨ ਜੋ ਸਹੀ ਮਾਇਨੇ ਵਿੱਚ ਸੰਗੀਤ ਨਾਲ ਜੁੜੇ ਹਨ ਉਨ੍ਹਾਂ ਦੀ ਗਾਇਕੀ ਨੂੰ ਵੀ ਗਲੋਬਲ ਪੱਧਰ ਤੱਕ ਲਿਜਾਣਾ ਚਾਹੀਦਾ ਹੈ